ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹਨ ਪਰ ਅੱਜ ਕੱਲ੍ਹ ਕਿਸਾਨਾਂ ਦੀ ਖੁਦਕੁਸ਼ੀ ਦੇ ਕਿੱਸੇ ਕਾਫੀ ਜ਼ਿਆਦਾ ਵੱਧ ਚੁੱਕੇ ਹਨ ਇਸ ਦਾ ਸਭ ਤੋਂ ਬੜਾ ਕਾਰਨ ਹੈ ਫਸਲਾਂ ਦਾ ਨੁਕਸਾਨ ਹੋਣਾ ਜੋ ਕਿ ਖਰਾਬ ਮੌਸਮ ਕਾਰਨ ਵੀ ਹੋ ਜਾਂਦਾ ਹੈ ਕਈ ਵਾਰ ਬੀਜਾਂ ਦੇ ਕਾਰਨ ਕੋਈ ਬਿਮਾਰੀ ਦੇ ਕਾਰਨ ਜਿਸ ਕਾਰਨ ਕਿਸਾਨ ਨੁਕਸਾਨ ਹੋਣ ਕਾਰਨ ਕਿਸਾਨ ਖੁਦਕੁਸ਼ੀ ਕਰਦੇ ਹਨ ਕੁਛ ਕਿਸਾਨ ਲੋਨ ਨਾ ਚੁੱਕਤਾ ਕਰਨ ਦੇ ਕਾਰਨ ਵੀ ਖੁਦਕੁਸ਼ੀ ਕਰ ਲੈਂਦੇ ਹਨ ਇਸ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਲੋਨਾਂ ਦੇ ਉੱਤੇ ਰਿਆਇਤ ਦੇਣ ਅਤੇ ਜਿਹੜੀ ਉਨ੍ਹਾਂ ਦੀ ਫਸਲ ਕਿਸੇ ਮੌਸਮ ਜਾਂ ਫਿਰ ਬੀਜ ਕਾਰਨ ਜਾਂ ਬਿਮਾਰੀ ਕਾਰਨ ਖਰਾਬ ਹੁੰਦੀ ਹੈ ਉਸ ਉੱਤੇ ਉਨ੍ਹਾਂ ਨੂੰ ਮੁਆਵਜ਼ਾ ਦੇਣ